ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਕਈ ਆਜ਼ਾਦੀ ਘੁਲਾਟੀ ਸ਼ਾਮਿਲ ਸਨ ਜਿਵੇਂ ਕਿ ਕਰਤਾਰ ਸਿੰਘ ਸਰਾਭਾ ਸ਼ਹੀਦ ਊਧਮ ਸਿੰਘ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮਹਾਤਮਾ ਗਾਂਧੀ ਅਤੇ ਚੰਦਰਸ਼ੇਖਰ ਆਜ਼ਾਦ ਆਦਿ ਸ਼ਹੀਦ ਭਗਤ ਸਿੰਘ ਜਿਹੜੇ ਕਿ ਪੰਜਾਬ ਦੇ ਰਹਿਣ ਵਾਲੇ ਸਨ ਉਹ ਗਰਮ ਮਾਤਰ ਦੇ ਸਨ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਆਜ਼ਾਦੀ ਸ਼ਾਂਤੀ ਨਾਲ ਨਹੀਂ ਮਿਲ ਸਕਦੀ ਸਾਨੂੰ ਹਥਿਆਰ ਚੁੱਕਣੇ ਹੀ ਪੈਣਗੇ ਉਹਨਾਂ ਨੇ ਅੰਗਰੇਜ਼ਾਂ ਨੂੰ ਡਰਾਉਣ ਲਈ ਗੈਸ ਵਾਲਾ ਬੰਬ ਅਸੈਂਬਲੀ ਵਿੱਚ ਸੁੱਟਿਆ ਅਤੇ ਉਹ ਬੰਬ ਸੁੱਟ ਕੇ ਉੱਥੋਂ ਭੱਜੇ ਨਹੀਂ ਸਗੋਂ ਉੱਥੇ ਖੜ੍ਹੇ ਰਹੇ ਅਤੇ ਉਹਨਾਂ ਨੂੰ ਬੰਬ ਸੁੱਟਣ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਾਲ ਉਨ੍ਹਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਇਹਨਾਂ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਸ਼ਹੀਦ ਊਧਮ ਸਿੰਘ ਉਨ੍ਹਾਂ ਨੇ ਜਨਰਲ ਐਡਵਾਇਰ ਜਿਸਨੇ ਜਲ੍ਹਿਆਂਵਾਲੇ ਬਾਗ 'ਤੇ ਹਮਲਾ ਕਰਵਾਇਆ ਸੀ ਉਸ ਨੂੰ ਇੰਗਲੈਂਡ ਜਾ ਕੇ ਅਸੈਂਬਲੀ ਵਿੱਚ ਗੋਲੀ ਮਾਰੀ ਅਤੇ ਸ਼ਹੀਦ ਊਧਮ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਉਹਨਾਂ ਦੀ ਪਾਲਣਾ ਯਤੀਮਖਾਨੇ ਵਿੱਚ ਹੋਈ ਉਹਨਾਂ ਨੇ ਜਲ੍ਹਿਆਂਵਾਲੇ ਬਾਗ ਦਾ ਸਾਕਾ ਆਪਣੇ ਅੱਖੀ ਵੇਖਿਆ ਸੀ ਅਤੇ ਉਹ ਇਹ ਦੇਖ ਕੇ ਉਹਨਾਂ ਦਾ ਖੂਨ ਖੋਲ ਉੱਠਿਆ ਸੀ